ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬ ਵਿੱਚ ਮੀਡੀਆ ਅਤੇ ਪੱਤਰਕਾਰਤਾ ਨੂੰ ਉਤਸ਼ਾਹ ਕਰਨ ਲਈ ਕਈ ਮੁੱਖ ਖਬਰਾਂ ਦੀਆਂ ਪਹਿਲਕਦਮੀਆਂ ਅਤੇ ਪ੍ਰੋਗਰਾਮ ਚਲਾਏ ਜਾਂਦੇ ਹਨ ਇਹਨਾਂ ਦਾ ਮਕਸਦ ਪਤਾ ਪੱਤਰਕਾਰੀ ਨੂੰ ਵਧਾਵਾ ਦੇਣਾ ਹੁੰਦਾ ਹੈ ਪੱਤਰਕਾਰੀ ਸਿਖਲਾਈ ਅਤੇ ਮੀਡੀਆ ਅਵੋਡ ਪਹਿਲਾਂ ਪੰਜਾਬ ਪੱਤਰਕਾਰੀ ਅਵਾਰਡ ਹਰ ਸਾਲ ਚੰਗੀ ਪੱਤਰਕਾਰੀ ਨੂੰ ਸਨਮਾਨਿਤ ਕੀਤਾ ਜਾਂਦਾ ਹੈ ਮਾਸ ਕੋਮਨੀਕੇਸ਼ਨ ਅਤੇ ਜਨਰਲਿਜ਼ਮ ਕੋਰਸ ਜਿਹੜਾ ਹੁੰਦਾ ਹੈ ਪੰਜਾਬ ਯੂਨੀਵਰਸਿਟੀ ਵੱਲੋਂ ਜਿਹੜਾ ਜਿਵੇਂ ਕਿ ਜੀਐਨਡੀਯੂ ਪੇਟੀਯੂ ਪੀਯੂ ਐਲਪੀਯੂ ਵੱਲੋਂ ਜਿਹੜਾ ਹੁੰਦਾ ਹੈ ਸਮਾਜਿਕ ਅਤੇ ਲੋਕਤੰਤਰ ਮੀਡੀਆ ਪਹਿਲ ਕਦਮੀਆਂ ਜਿਹੜੀਆਂ ਹੁੰਦੀਆਂ ਹਨ ਪੰਜਾਬ ਮੀਡੀਆ ਮਾਨ ਮੋਨੀਟਰ ਜਿਵੇਂ ਜਿਹਦੇ ਵਿੱਚ ਨਕਲੀ ਖਬਰਾਂ ਦੀ ਜਾਂਚ ਕੀਤੀ ਜਾਂਦੀ ਹੈ ਵੀ ਕੋਈ ਨਕਲੀ ਖਬਰ ਤਾਂ ਨਹੀਂ ਛਪੀ ਜਾ ਰਹੀ ਦੂਜਾ ਹੁੰਦਾ ਸਿੱਖ ਮੀਡੀਆ ਸਿੱਖ ਮੀਡੀਆ ਇਨੋਵੇਸ਼ਨ ਜਿਹੜੀ ਹੁੰਦੀ ਹੈ ਜਿਹਦੇ ਵਿੱਚ ਧਾਰਮਿਕ ਅਤੇ ਇਤਿਹਾਸਿਕ ਮਾਮਲਿਆਂ ਵਾਲਾ ਕੰਮ ਕੀਤਾ ਜਾਂਦਾ ਹੈ ਤੀਜਾ ਅਸੀਂ ਕਹਿ ਸਕਦੇ ਹਾਂ ਪੰਜਾਬ ਡਿਜੀਟਲ ਮੀਡੀਆ ਜਿਹਦੇ ਵਿੱਚ ਡਿਜੀਟਲ ਪੱਤਰਕਾਰਾਂ ਲਈ ਹੁੰਦਾ ਹੈ ਅਤੇ ਇਹ ਮੀਡੀਆ ਸੰਮੇਲਨ ਅਤੇ ਵਰਕਸ਼ਾਪ ਜਿਹੜੇ ਲਗਾਏ ਜਾਂਦੇ ਹਨ ਅਤੇ ਇਹਦੇ ਵਿੱਚ ਕਿਸਾਨ ਮੀਡੀਆ ਸੈਸ਼ਨ ਵੀ ਹੁੰਦਾ ਕਿਸਾਨ ਅਤੇ ਗ੍ਰਾਮੀਣ ਖੇਤਰ ਸੀ ਪੱਤਰਕਾਰੀ ਉਤਸਾਹ ਕਰਨ ਲਈ ਬਸਤੀ ਵਰਤਿਆ ਜਾਂਦਾ ਹੈ ਅਤੇ ਦੂ ਅਗਲਾ ਆਜ਼ਾਦ ਮੀਡੀਆ ਅਤੇ ਪੱਤਰਕਾਰੀ ਅਧਿਕਾਰ ਵੀ ਹੁੰਦੇ ਹਨ ਆਰਟੀਆਈ ਸੂਚਨਾ ਅਧਿਕਾਰਿਤ ਅਭਿਆਨ ਜਿਹੜਾ ਚਲਾਇਆ ਜਾਂਦਾ ਹੈ ਪੰਜ ਸਰਕਾਰੀ ਜਾਣਕਾਰੀ ਨੂੰ ਪ੍ਰਾਪਤ ਕਰਨ ਵਾਸਤੇ ਇਹ ਸਭ ਮੁਹਿੰਮਾ ਅਤੇ ਪ੍ਰੋਗਰਾਮ ਪੰਜਾਬ ਵਿੱਚ ਪੱਤਰਕਾਰੀ ਅਤੇ ਮੀਡੀਆ ਦੀ ਆਜ਼ਾਦੀ ਗੁਣਵੱਤਾ ਅਤੇ ਵਾਧੂ ਵਿਕਾਸ ਲਈ ਮਹੱਤਵਪੂਰਨ ਯੋਗਦਾਨ ਪਾਉਂਦੇ ਹਨ ਅਤੇ ਜਿਹੜਾ ਪੰਜਾਬ ਵਿੱਚ ਕਿਸਾਨ ਅੰਦੋਲਨ ਚੱਲਿਆ ਸੀ ਉਹਨੂੰ ਅਤੇ ਬਹੁਤ ਜ਼ਿਆਦਾ ਵੱਧ ਚੜ੍ਹ ਕੇ ਦਿਖਾਇਆ ਗਿਆ ਸੀ ਅਤੇ ਮੀਡੀਆ ਸਾਨੂੰ ਜਿਹੜਾ ਹੈ ਪੜ੍ਹਾਈ ਲਿਖਾਈ ਦੇ ਨੂੰ ਵੀ ਬਹੁਤ ਜ਼ਿਆਦਾ ਪ੍ਰਮੋਟ ਕਰਦੀ ਹੈ ਜਿਵੇਂ ਪੰਜਾਬ ਸਰਕਾਰ ਵੱਲੋਂ ਸਕੀਮਾਂ ਚਲਾਈ ਜਾਂਦੀਆਂ ਹਨ ਵੀ ਇੰਨੇ ਤੋਂ ਇੰਨੇ ਲੈ ਕੇ ਬੱਚੇ ਤੋਂ ਜਿਹੜੇ ਹੈਗੇ ਆ ਉਹਨਾਂ ਨੂੰ ਸਕੂਲਾਂ ਵਿੱਚ ਹੀ ਪੰਜਾ ਸਰਕਾਰ ਵੀ ਸਕੂਲਾਂ ਵਿੱਚ ਹੀ ਉਹ ਮਿਡ ਡੇ ਮੀਲ ਪ੍ਰੋਵਾਈਡ ਕੀਤੀ ਜਾਵੇਗੀ ਅਤੇ ਹੋਰ ਵੀ ਵੱਖਰੀਆਂ ਵੱਖਰੀਆਂ ਉਹਨਾਂ ਨੂੰ ਚੀਜ਼ਾਂ ਦਿੱਤੀਆਂ ਜਾਂਦੀਆਂ ਹਨ ਅਤੇ ਉਹਨਾਂ ਨੂੰ ਪੜ੍ਹਾਇਆ ਜਾਂਦਾ ਹੈ ਧੰਨਵਾਦ